ਨਹੀਂ ਇਹ ਅਸੀਂ ਨਹੀਂ ਸੋਚਦੇ ਵੀ ਪੇਂਡੂ ਖੇਤਰਾਂ ਵਿੱਚ ਨੌਜਵਾਨ ਪੀੜ੍ਹੀ ਨੂੰ ਜੀਵਨ ਸਾਥੀ ਪ੍ਰਾਪਤ ਕਰਨ ਵਿੱਚ ਕੋਈ ਔਖਿਆਈ ਆਉਂਦੀ ਹੈ ਹਾਂ ਥੋੜ੍ਹਾ ਸ਼ਹਿਰਾਂ ਵਿੱਚ ਸਹੂਲਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਥੋੜ੍ਹਾ ਜਿਹਾ ਲੋਕ ਸੈ ਸ਼ਹਿਰ ਨੂੰ ਜ਼ਿਆਦਾ ਭੱਜਦੇ ਆ ਪਰ ਇਸ ਵਿੱਚ ਕੋਈ ਦੋ ਰਾਏ ਨਹੀਂ ਵੀ ਪੇਂਡੂ ਖੇਤਰ ਵਿੱਚ ਵੀ ਵਧੀਆ ਜੀਵਨ ਸਾਥੀ ਪ੍ਰਾਪਤ ਹੋ ਜਾਂਦਾ ਆਸਾਨੀ ਨਾਲ ਬਾਕੀ ਟੈਮ ਟੈਮ 'ਤੇ ਜੋ ਨੌਜਵਾਨ ਪੀੜ੍ਹੀ ਨੂੰ ਵਧੀਆ ਲੱਗਦਾ ਏ ਉਹ ਚੱਲਦਾ ਏ